ਹਾਂਜੀ ਧਾਰਮਿਕ ਮੌਕਿਆਂ 'ਤੇ ਸਾਰੇ ਪੂਜਾ ਕਰਦੇ ਆ ਕੋਈ ਨਾ ਕੋਈ ਪਰ ਅਸੀਂ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦੇ ਹਾਂ ਇਸ ਕਰਕੇ ਸਾਡੇ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਤਾਂ ਤਿਉਹਾਰ 'ਤੇ ਗੁਰਦੁਆਰਾ ਸਾਹਿਬ ਹੀ ਜਾਇਆ ਜਾਂਦਾ ਉੱਥੇ ਹੀ ਮੱਥਾ ਟੇਕਣ ਜਾਂਦੇ ਹਾਂ ਰਾਤ ਨੂੰ ਵੀ ਜਿਵੇਂ ਦੀਵੇ ਵਗੈਰਾ ਲਗਾਉਣ ਜਾਂਦੇ ਹਾਂ ਗੁਰਪੁਰਬ ਹੋਵੇ ਦਿਵਾਲੀ ਹੋਵੇ ਗੁਰਦੁਆਰੇ ਹੀ ਜਾਇਆ ਜਾਂਦਾ ਦੇਗ ਚੜ੍ਹਾ ਕੇ ਆਈ ਜਾਂਦੀ ਹੈ ਜਾਂ ਕੋਈ ਮਿਠਿਆਈ ਦਾ ਡੱਬੇ ਦੇ ਕੇ ਆ ਜਾਂਦੇ ਹਾਂ ਅਤੇ ਮੂਰਤੀ ਕੋਈ ਨਹੀਂ ਬਣਾਈ ਜਾਂਦੀ ਅਤੇ ਨਾ ਹੀ ਅਸੀਂ ਘਰ ਵਿੱਚ ਵੀ ਕੋਈ ਮੂਰਤੀਆਂ ਲਗਾਉਂਦੇ ਹਾਂ ਬਸ ਤਿਉਹਾਰ ਸਾਡਾ ਗੁਰਦੁਆਰਾ ਸਾਹਿਬ ਤੋਂ ਹੀ ਸ਼ੁਰੂ ਹੁੰਦਾ ਹੈਗਾ ਅਤੇ ਰਾਤ ਨੂੰ ਗੁਰਦੁਆਰਾ ਸਾਹਿਬ 'ਤੇ ਹੀ ਖ਼ਤਮ ਹੁੰਦਾ ਹੈਗਾ ਪਰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਇਹ ਬੰਦੇ ਦੇ ਮਨ 'ਚ ਸ਼ਰਧਾ ਹੋਣੀ ਚਾਹੀਦੀ ਹੈ ਰੱਬ ਸਾਰਿਆ ਲਈ ਇੱਕੋ ਹੀ ਹੁੰਦਾ ਪਰ ਠੀਕ ਹੈ ਜਿਹੋ ਜਿਹੀਆਂ ਆਪਣੇ ਇੱਥੇ ਕਾਸਟ ਦਾ ਸਿਸਟਮ ਬਣਿਆ ਹੋਇਆ ਵੀ ਇਹ ਸਿੱਖ ਹੈਗੇ ਹਿੰਦੂ ਹੈ ਇਹ ਗੁਰਦੁਆਰੇ ਜਾਣਗੇ ਇਹ ਮੰਦਰ ਜਾਣਗੇ ਨਹੀਂ ਤਾਂ ਕੋਈ ਇਹ ਤਾਂ ਹੈ ਨਹੀਂ ਵੀ ਜੇ ਗੁਰਦੁਆਰੇ 'ਚ ਕੋਈ ਹਿੰਦੂ ਆ ਗਿਆ ਤਾਂ ਗੁਰਦੁਆਰੇ ਵਾਲੇ ਬਾਹਰ ਕੱਢ ਦੇਣਗੇ ਜਾਂ ਮੰਦਰ 'ਚ ਕੋਈ ਸਿੱਖ ਚਲਾ ਗਿਆ ਤਾਂ ਉਹ ਉਹਨੂੰ ਬਾਹਰ ਕੱਢ ਦੇਣਗੇ ਇਹ ਤੁਹਾਡੇ ਆਪਣੇ ਮਨ ਦੀ ਬਸ ਇੱਕ ਸ਼ਰਧਾ ਹੁੰਦੀ ਹੈ ਅਤੇ ਤਿਉਹਾਰ ਨੂੰ ਮਨਾਉਣ ਦਾ ਇੱਕ ਅਲੱਗ ਅਲੱਗ ਹਰੇਕ ਬੰਦੇ ਦੇ ਤਰੀਕੇ ਹੁੰਦੇ ਆ ਹਰੇਕ ਹਰ ਸਾਰਿਆਂ ਦਾ ਕਲਚਰ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ ਹੈਗਾ